ਸਾਡੇ ਖੇਤਰ ਵਿੱਚ ਮਹੱਤਵਪੂਰਨ ਪਕਵਾਨ ਜਿਵੇਂ ਕਿ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਮੱਖਣ ਲੱਸੀ ਬਹੁਤ ਮਸ਼ਹੂਰ ਹਨ ਇੱਥੇ ਆਮ ਹੀ ਲੋਕ ਸਰੋਂ ਦਾ ਸਾਗ ਮੱਕੀ ਦੀ ਰੋਟੀ ਬੜੇ ਚਾਅ ਨਾਲ ਖਾਂਦੇ ਹਨ ਸਾਡੇ ਬਹੁਤ ਵਧੀਆ ਵਧੀਆ ਰੈਸਟੋਰੈਂਟ ਅਤੇ ਢਾਬੇ ਹਨ ਸਾਡੇ ਲਾਗੇ ਜਿਵੇਂ ਕਿ ਸਬਵੇ ਖੁੱਲ੍ਹਾ ਆਇਆ ਹੈ ਔਰ ਦਾਣਾ ਪਾਣੀ ਭਰਾਵਾਂ ਦਾ ਢਾਬਾ ਜੋ ਕਿ ਇੱਥੇ ਬਹੁਤ ਵਧੀਆ ਕਿਸਮ ਦੀਆਂ ਸਬਜ਼ੀਆਂ ਦਾਲਾਂ ਸ਼ਾਹੀ ਪਨੀਰ ਮੱਕੀ ਦੀ ਰੋਟੀ ਅਤੇ ਨਾਲ ਸਾਗ ਬਣਾਉਂਦੇ ਹਨ ਔਰ ਲੋਕਾਂ ਨੂੰ ਬਹੁਤ ਹੀ ਵਧੀਆ ਤਰ੍ਹਾਂ ਦੇ ਪਕਵਾਨ ਖਾਂਦੇ ਹਨ ਸਾਡੇ ਪੰਜਾਬੀ ਖਾਣ ਪੀਣ ਦੇ ਬਹੁਤ ਸ਼ੌਕੀਨ ਹਨ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਡੇ ਲੋਕ ਇਹਨਾਂ ਸਥਾਨਾਂ 'ਤੇ ਜਾ ਕੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਮੱਖਣ ਅਤੇ ਲੱਸੀ ਦਾ ਸੇਵਨ ਕਰਦੇ ਹਨ ਜੋ ਕਿ ਸਾਡੇ ਪੰਜਾਬ ਵਿੱਚ ਬਹੁਤ ਹੀ ਪ੍ਰਸਿੱਧ ਹਨ